ਹਾਂਜੀ ਭਾਅ ਜੀ ਮੈਂ ਮੋਹਿਤ ਅਰੋੜਾ ਬੋਲ ਰਿਹਾਂ ਮੈਂ ਇੱਕ ਕੈਬ ਬੁੱਕ ਕੀਤੀ ਹੈ ਤੁਹਾਡੀ ਜੋ ਕਿ ਮੈਂ ਰੇਲਵੇ ਸਟੇਸ਼ਨ ਤੱਕ ਜਾਣਾ ਹੈ ਤੁਸੀਂ ਕਿੱਥੇ ਹੋ ਤੁਸੀਂ ਜਲਦੀ ਆ ਜਾਓ ਮੇਰੀ ਟਰੇਨ ਨਾ ਮਿਸ ਹੋ ਜਾਵੇ ਮੈਂ ਹੋਰ ਵੀ ਕਿਤੇ ਜਾਣਾ ਸੀ ਤੁਸੀਂ ਜਲਦੀ ਆ ਸਕਦੇ ਹੋ ਕਿ ਨਹੀਂ ਮੈਨੂੰ ਉਹ ਦੱਸੋ ਅੱਧੇ ਘੰਟੇ ਤੱਕ ਅੱਧੇ ਘੰਟੇ ਤੱਕ ਤਾਂ ਲੇਟ ਨਾ ਕਰਿਓ ਫਿਰ ਮੈਂ ਕਿਤੇ ਜਾਣਾ ਜੇ ਮੇਰੀ ਟਰੇਨ ਨਿਕਲ ਜਾਣੀ ਹੈ ਮੈਨੂੰ ਫਿਰ ਬੜਾ ਹੀ ਨੁਕਸਾਨ ਹੋ ਜਾਣਾ ਜੇ ਜੇ ਤਾਂ ਅੱਧੇ ਘੰਟੇ ਤੱਕ ਆ ਸਕਦੇ ਹੋ ਤਾਂ ਮੈਨੂੰ ਦੱਸ ਦਿਓ ਤੁਸੀਂ ਜਲਦੀ ਆ ਜਾਓ ਫਿਰ ਮੈਂ ਥੱਲੇ ਆ ਜਾਵਾਂਗਾ ਮੈਂ ਸੈਕਿੰਡ ਫਲੋਰ ਦੇ ਉੱਤੇ ਰਹਿੰਦਾ ਮੈਨੂੰ ਇੱਦਾਂ ਕਰਿਓ ਪਾਰਵਤੀ ਹੋਸਪਿਟਲ ਦੇ ਕੋਲ ਆ ਕੇ ਹੀ ਫੋਨ ਕਰ ਲਿਓ ਮੈਂ ਉੱਥੇ ਤੱਕ ਹੀ ਬਾਹਰ ਆ ਜਾਵਾਂਗਾ ਤਾਂ ਕਿ ਟਾਈਮ ਦੀ ਬੱਚਤ ਹੋਵੇ ਅਤੇ ਅਸੀਂ ਦਵਾ ਦਵਾ ਆਪਣੇ ਸਟੇਸ਼ਨ ਤੱਕ ਮੈਨੂੰ ਛੱਡ ਦਿਓ ਮੈਂ ਮੇਰੀ ਟਰੇਨ ਮਿਸ ਹੋ ਗਈ ਤਾਂ ਬੜਾ ਨੁਕਸਾਨ ਹੋ ਜਾਣਾ ਜੇ ਜਲਦੀ ਕਰ ਦਿਓ ਪਲੀਜ਼ ਆ ਜਾਓ ਆ ਜਾਓ ਜਲਦੀ ਆ ਜਾਓ